ਮੈਂ ਇਸ ਸਮੇਂ ਯੂਟੀਊਬ ਵਿੱਚ ਵਾਧੂ ਸਾਹਿਤ ਹਾਂ ਮੈਂ ਯੂਟੀਊਬ 'ਤੇ ਵੀਡੀਓ ਬਣਾ ਕੇ ਬਹੁਤ ਸਾਰੇ ਲਾਇਕਸ ਕ ਲੈਂਦਾ ਹਾਂ ਲੋਕ ਮੈਨੂੰ ਬਹੁਤ ਪਸੰਦ ਕਰਦੇ ਹਨ ਬਹੁਤ ਵਧੀਆ ਵਧੀਆ ਕਮੈਂਟਸ ਕਰਦੇ ਹਨ ਅਤੇ ਕੁਛ ਕਮੈਂਟਸ ਬੁਰੇ ਵੀ ਹੁੰਦੇ ਹਨ ਲੋਕ ਬਹੁਤ ਹੀ ਸ਼ੇਅਰ ਕਰਦੇ ਹਨ ਮੈਂ ਯੂਟੀਊਬ ਤੋਂ ਪੈਸੇ ਕਮਾਉਂਦਾ ਹਾਂ ਮੈਂ ਬਹੁਤ ਪੈਸਾ ਕਮਾ ਚੁੱਕਿਆ ਹੁਣ ਤੱਕ ਪਰ ਮੈਨੂੰ ਪਹਿਲਾਂ ਯੂਟੀਊਬ ਚਲਾਉਣੀ ਨਹੀਂ ਆਉਂਦੀ ਸੀ ਮੇਰੇ ਬੇਲੀ ਨੇ ਮੈਨੂੰ ਯੂਟੀਊਬ ਚਲਾਉਣੀ ਸਿਖਾਈ ਵੀਡੀਓ ਬਣਾਉਣੀ ਸਿਖਾਈ ਅਤੇ ਉਸਨੇ ਦੱਸਿਆ ਕਿ ਆਪਾਂ ਇਸ ਤੋਂ ਬਹੁਤ ਸਾਰੇ ਪੈਸੇ ਕਮਾ ਸਕਦੇ ਹਾਂ ਬਹੁਤ ਸਾਰੇ ਪੈਸੇ ਕਮਾ ਸਕਦੇ ਹਾਂ ਯੂਟੀਊਬ ਬਹੁਤ ਵਧੀਆ ਚੀਜ਼ ਹੈ ਇਹ ਅੱਜ ਕੱਲ੍ਹ ਦਾ ਨਵੀਨਤਮ ਉਤਸ਼ਾਹੀ ਤਕਨੀਕ ਹੈ ਇਸ ਵਿੱਚ ਮੈਨੂੰ ਬਹੁਤ ਰੁਝਾਨ ਹੈ ਯੂਟੀਊਬ 'ਤੇ ਬਹੁਤ ਸਾਰੇ ਪੈਸੇ ਕਮਾਏ ਜਾ ਸਕਦੇ ਹਨ ਥਰੀ ਡੀ ਪ੍ਰਿੰਟਿੰਗ ਥਰੀ ਡੀ ਪ੍ਰਿੰਟਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਕਾ ਜਿਸ ਨਾਲ ਸਾਨੂੰ ਹਰੇਕ ਪ੍ਰਿੰਟਿੰਗ ਐਚ ਡੀ ਦਿਖਾ ਐਚ ਡੀ ਦਿਖਦੀ ਹੈ ਜਿਵੇਂ ਕਿ ਉਹ ਓਰੀਜਨਲ ਹੋਵੇ ਬਟ ਪਰ ਅਜਿਹਾ ਕੁਝ ਨਹੀਂ ਹੁੰਦਾ ਆਪਾਂ ਉਸ ਵਿੱਚ ਇੱਕ ਤਕਨੀਕ ਹੈ ਆਪਾਂ ਉਸ ਵਿੱਚ ਪੂਰੇ ਰੁੱਝ ਜਾਂਦੇ ਹਾਂ ਜਿਵੇਂ ਕਿ ਆਪਾਂ ਹੀ ਉਸ ਐਚ ਡੀ ਥਰੀ ਡੀ ਪ੍ਰਿੰਟਿੰਗ ਦੇ ਹਿੱਸੇ ਹੋਈਏ ਆਪਾਂ ਉਸੀ ਦੁਨੀਆ ਦੇ ਵਿੱਚ ਰਹਿਣ ਵਾਲੇ ਹੋਈਏ ਇਹ ਬਿਲਕੁਲ ਅਸਲੀ ਅਤੇ ਵਧੀਆ ਇਹ ਬਿਲਕੁਲ ਅਸਲੀ ਅਤੇ ਵਧੀਆ ਲੱਗਦੀ ਹੈ ਹਾਂ ਆਪਾਂ ਇਹ ਸੋਚ ਵੀ ਨਹੀਂ ਸਕਦੇ ਕਿ ਇਹ ਨਕਲੀ ਹੈ ਜਾਂ ਅਸਲੀ ਆਪਾਂ ਬਿਲਕੁਲ ਉਸ ਦੇ ਵਿੱਚ ਖੋ ਜਾਂਦੇ ਹਾਂ ਇਹ ਬਹੁਤ ਹੀ ਵਧੀਆ ਪ੍ਰਿੰਟਿੰਗ ਹੈ ਸਮਾਰਟ ਡਿਵਾਈਸ ਇਹ ਇੱਕ ਮੇਰਾ ਫੋਨ ਇੱਕ ਸਮਾਰਟ ਡਿਵਾਈਜ਼ ਜਿਸ 'ਤੇ ਮੈਂ ਯੂਟੀਊਬ ਇੰਸਟਾਗਮ ਅਤੇ ਫੇਸਬੁੱਕ ਵਰਗੀਆਂ ਐਪਸ ਚਲਾ ਕੇ ਉਸ 'ਤੇ ਬਹੁਤ ਸਾਰੇ ਪੈਸੇ ਕਮਾਉਂਦਾ ਹਾਂ ਬਹੁਤ ਸਾਰੇ ਲਾਈਕਸ ਕਮੈਂਟਸ ਮਿਲਦੇ ਹਨ ਇਸ 'ਤੇ ਮੈਨੂੰ ਬਹੁਤ ਸਾਰੇ ਚੰਗੇ ਕਮੈਂਟਸ ਅਤੇ ਮਾੜੇ ਕਮੈਂਟਸ ਵੀ ਆਉਂਦੇ ਹਨ ਬਟ ਕੋਈ ਗੱਲ ਨਹੀਂ ਬਹੁਤ ਸਾਰੇ ਪੈਸੇ ਮੈਂ ਜਿਸ ਚੀਜ਼ ਤੋਂ ਕਮਾ ਸਕਦਾ ਹਾਂ ਮੈਨੂੰ ਬਹੁਤ ਸਾਰਾ ਪਿਆਰ ਮਿਲਦਾ ਹੈ ਸਤਿਕਾਰ ਮਿਲਦਾ ਹੈ